ਅਠਾਰਾਂ ਚਾਰ ਸੌ ਇੱਕੀ ਸੱਤ ਹਜ਼ਾਰ ਅੱਠ ਸੌ ਇਕਾਹਠ ਪੱਚੀ ਪੱਚੀ ਹਜ਼ਾਰ ਨੌਂ ਸੌ ਅਠੱਤੀ ਇੱਕ ਲੱਖ ਬਾਈ ਹਜ਼ਾਰ ਨੌਂ ਸੌ ਪੰਜ